ਮੇਰਾ ਨਾਮ ਗੁਰਵਿੰਦਰ ਸਿੰਘ ਆ ਮਾਲਵੇ ਖੇਤਰ ਦੇ ਵਿੱਚ ਬਠਿੰਡਾ ਸ਼ਹਿਰ ਹੈ ਮੇਰਾ ਤਾਂ ਮੈਂ ਮਾਲਵੇ ਖੇਤਰ ਦੀ ਗੱਲ ਕਰਾਂ ਤਾਂ ਇੱਥੋਂ ਬਹੁਤ ਵੱਡੇ ਇਹਦੇ ਸਕੂਲ ਨੇ ਅੱਛੇ ਨਾਮਵਰ ਸਕੂਲ ਨੇ ਨਾਮਵਾਰ ਯੂਨੀਵਰਸਿਟੀਆਂ ਨੇ ਪਰ ਫਿਰ ਵੀ ਜਦੋਂ ਲੋਕਾਂ ਨੇ ਆਪਣੇ ਦਿਲ ਦੀ ਗੱਲ ਕਰਨੀ ਹੈ ਤਾਂ ਉਹ ਆਪਣੀ ਖੇਤਰੀ ਭਾਸ਼ਾ 'ਚ ਕਰਦੇ ਨੇ ਗੱਲ ਪੰਜਾਬੀ ਭਾਸ਼ਾ ਮਾਂ ਬੋਲੀ 'ਚ ਹੀ ਗੱਲ ਕਰਦੇ ਨੇ ਕਿਉਂਕਿ ਤੁਸੀਂ ਥੋੜ੍ਹੀ ਦਫਤਰੀ ਭਾਸ਼ਾ ਜਾਂ ਕਮਿਊਨੀਕੇਸ਼ਨ ਦੀ ਭਾਸ਼ਾ ਸੰਚਾਰ ਦੀ ਭਾਸ਼ਾ ਕਿਸੇ ਬਿਜਨਸ 'ਚ ਤਾਂ ਹੋ ਸਕਦੀ ਜਿਹੜੀ ਪ੍ਰੋਫੈਸ਼ਨਲ ਭਾਸ਼ਾ ਬਿਜਨਸ 'ਚ ਤਾਂ ਹੋ ਸਕਦੀ ਹੈ ਪਰ ਆਮ ਭਾਸ਼ਾ ਸੋਰੀ ਖੇਤਰੀ ਭਾਸ਼ਾ ਹੀ ਹੈ ਦਿਲ ਦੀ ਭਾਸ਼ਾ ਜਿਹੜੀ ਅਸੀਂ ਲੋਕਾਂ ਨਾਲ ਗੱਲ ਕਰੀਏ ਲੋਕਾਂ ਨੂੰ ਸਮਝੀਏ ਦਿਲ ਦੀਆਂ ਦਿਲ ਤੱਕ ਗੱਲਾਂ ਜੁੜਦੀਆਂ ਨੇ ਆਮ ਭਾਸ਼ਾ ਨਾਲ ਤੁਸੀਂ ਕਿਤੋਂ ਵੀ ਕਿਸੇ ਵੀ ਮੈਗਜ਼ੀਨ ਦਾ ਸਰਵੇ ਲੈ ਲਓ ਕਿਸੇ ਅਖਬਾਰ ਦਾ ਆਰਟੀਕਲ ਲੈ ਲਓ ਲੇਖ ਲੈ ਲਓ ਇੱਥੇ ਨੱਬੇ ਤੋਂ ਲੈ ਕੇ ਨੜਿਨਵੇਂ ਪ੍ਰਸੈਂਟ ਆਬਾਦੀ ਦੇ ਲੋਕ ਮਾਤਰ ਭਾਸ਼ਾ ਪੰਜਾਬੀ 'ਚ ਗੱਲ ਕਰਦੇ ਨੇ ਪੰਜਾਬੀ ਬੋਲਦੇ ਨੇ ਪੰਜਾਬੀ ਪੜ੍ਹਦੇ ਨੇ ਹਾਂ ਜਦੋਂ ਉਹ ਆਪਣੇ ਦਫਤਰੀ ਕੰਮ ਕਾਜ ਨੇ ਜਿੱਥੇ ਉਹਨਾਂ ਨੂੰ ਮਜਬੂਰੀ ਹੈ ਵੀ ਉਹਨਾਂ ਨੇ ਹਿੰਦੀ ਵਰਤੋਂ ਕਰਨੀ ਕਰਨੀ ਹੈ ਅੰਗਰੇਜ਼ੀ ਦੀ ਵਰਤੋਂ ਕਰਨੀ ਕਰਨੀ ਆ ਉਹ ਉੱਥੇ ਉਹ ਕਰਦੇ ਨੇ ਪਰ ਮੇਨ ਭਾਸ਼ਾ ਇਹਨਾਂ ਦੀ ਪੰਜਾਬੀ ਹੈ ਮਾਤਰ ਭਾਸ਼ਾ ਪੰਜਾਬੀ ਹੈ ਅਤੇ ਪੰਜਾਬੀ 'ਚ ਬੋਲਦੇ ਆ ਪੰਜਾਬੀ 'ਚ ਗੱਲ ਕਰਦੇ ਆ ਪੰਜਾਬੀ 'ਚ ਹੀ ਕਿਸੇ ਨੂੰ ਬਾ ਗੁਡ ਨਾਈਟ ਕਹਿਣੀ ਹੈ ਜਾਂ ਸ਼ੁਭਰਾਤਰੀ ਕਹਿਣੀ ਹੈ ਜਾਂ ਸੂਈ ਸਵੇਰ ਕਹਿਣੀ ਹੈ ਚੰਗੀ ਸਵੇਰ ਕਹਿਣੀ ਤਾਂ ਪੰਜਾਬੀ 'ਚ ਹੀ ਕਹਿੰਦੇ ਨੇ